ਹਾਂਜੀ ਮੈਂ ਇੱਦਾਂ ਦੇ ਇੱਕ ਵਿਸ਼ੇ 'ਤੇ ਬੋਲਣਾ ਚਾਹੁੰਦੀ ਹਾਂ ਜਿਨ੍ਹਾਂ 'ਤੇ ਬਹੁਤ ਘੱਟ ਬੋਲਿਆ ਜਾ ਰਿਹਾ ਏ ਜਿਵੇਂ ਕਿ ਅੱਜ ਕੱਲ੍ਹ ਲੜਕੀਆਂ ਅੱਜ ਦੇ ਸਮਾਜ ਵਿੱਚ ਸੁਰਖਸ਼ਿਤ ਨਹੀਂ ਹਨ ਉਹ ਲੜਕੀਆਂ ਆਪਣੇ ਘਰ ਤੋਂ ਘਰ ਤੋਂ ਬਾਹਰ ਵੀ ਨਹੀਂ ਨਿਕਲ ਸਕਦੀਆਂ ਕਿਉਂਕਿ ਅਗਰ ਉਹ ਘਰ ਤੋਂ ਬਾਹਰ ਇਕੱਲੀਆਂ ਨਿਕਲਦੀਆਂ ਹਨ ਤਾਂ ਉਹਨਾਂ ਨੂੰ ਰਸਤੇ ਵਿੱਚ ਕੁਛ ਇੱਦਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਉਹਨਾਂ ਨੂੰ ਬਹੁਤ ਹੀ ਦੁੱਖਦਾਈ ਹੈ ਜੇ ਉਹ ਲੜਕੀਆਂ ਇਹਨਾਂ ਵਿਸ਼ਿਆਂ 'ਤੇ ਗੱਲ ਅਗਰ ਆਪਣੇ ਘਰਦਿਆਂ ਨਾਲ਼ ਵੀ ਕਰਦੀਆਂ ਹਨ ਤਾਂ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ ਆਵਾਜ਼ ਦਬਾਉਣ ਦੇ ਨਾਲ਼ ਉਹਨਾਂ ਦੇ ਦਿਮਾਗ਼ 'ਤੇ ਇੱਕ ਅਲੱਗ ਅਸਰ ਪੈਂਦਾ ਹੈ ਜੋ ਕਿ ਉਹਨਾਂ ਦੀ ਸਿਹਤ 'ਤੇ ਵੀ ਬਹੁਤ ਬੁਰਾ ਅਸਰ ਪਾਉਂਦਾ ਹੈ ਤਾਂ ਮੈਂ ਇਸ ਗੱਲ 'ਤੇ ਲਿਖਣਾ ਚਾਹਵਾਂਗੀ ਕਿ ਕੁੜੀਆਂ ਨੂੰ ਵੱਧ ਤੋਂ ਵੱਧ ਉਹ ਤਾਕਤਵਰ ਬਣਾਇਆ ਜਾਵੇ ਉਹਨਾਂ ਨੂੰ ਇਹ ਦੱਸਿਆ ਜਾਵੇ ਕਿ ਅਸੀਂ ਵੀ ਕਿਸੇ ਤੋਂ ਘੱਟ ਨਹੀਂ ਹਨ ਅਸੀਂ ਵੀ ਹਰ ਚੀਜ਼ ਕਰ ਸਕਦੀਆਂ ਹਨ ਅਸੀਂ ਵੀ ਲੜਕਿਆਂ ਦੇ ਬਰਾਬਰ ਖੜ੍ਹੇ ਹੋ ਕੇ ਕੰਮ ਕਰ ਸਕਦੀਆਂ ਹਨ ਅਤੇ ਹਰ ਚੀਜ਼ 'ਚ ਅੱਗੇ ਜਾ ਸਕਦੀਆਂ ਹਨ